ਹਾਂਜੀ ਨਮਸਕਾਰ ਜੀ ਮੈਂ ਇੱਥੋਂ ਆਈ ਸੀ ਦਿੱਲੀ ਤੋਂ ਕੁਛ ਫਰੈਂਡਸ ਨੇ ਨਾਲ ਅਤੇ ਇੱਥੇ ਫਾਜਿਲਕਾ ਸ਼ਹਿਰ 'ਚ ਦੇਖਣ ਵਾਲੀਆਂ ਕੀ ਕੀ ਚੀਜ਼ਾਂ ਨੇ ਮੇਨਲੀ ਪਾਰਕ ਵਗੈਰਾ ਹਾਂਜੀ ਅੱਛਾ ਅੱਛਾ ਅੱਛਾ ਅੱਛਾ ਅੱਛਾ ਬਾਰਡਰ ਇੱਥੇ ਪਾ ਕੇ ਕ ਕਿਹਦੇ ਨਾਲ ਰਲਦਾ ਬਾਰਡਰ ਨਹੀਂ ਅੱਗੋਂ ਕਿਹੜਾ ਬੇਸ਼ਕ ਦੇ ਨਾਲ ਲੱਗਦਾ ਪਾਕਿਸਤਾਨ ਨਾਲ ਅੱਛਾ ਅੱਛਾ ਅੱਛਾ ਅੱਛਾ ਅੱਛਾ ਅਤੇ ਪ੍ਰਤਾਪ ਬਾਗ ਦਾ ਨਾਮ ਹੈ ਪ੍ਰਤਾਪ ਦੇ ਨਾਮ 'ਤੇ ਕਿਉਂ ਰੱਖਿਆ ਮਹਾਰਾਣਾ ਪ੍ਰਤਾਪ ਦੇ ਨਾਮ 'ਤੇ ਪ੍ਰਤਾਪ ਅੱਛਾ ਅੱਛਾ ਅੱਛਾ ਅੱਛਾ ਅੱਛਾ ਇਹ ਪ੍ਰਤਾਪ ਕੌਣ ਸੀ ਪ੍ਰਤਾਪ ਕੋਈ ਪਰਸਨ ਸੀ ਅੱਛਾ ਓਕੇ ਅਤੇ ਹੋਰ ਹੋਰ ਕਿਹੜੀਆਂ ਜਗ੍ਹਾ ਨੇ ਇਸ ਤੋਂ ਇਲਾਵਾ ਕੋਈ ਕੁਛ ਹੈ ਇਸ ਤੋਂ ਇਲਾਵਾ ਵੀ ਕੁਛ ਹੈ ਬਾਗ ਤੋਂ ਇਲਾਵਾ

ਠੀਕ ਠੀਕ ਚਲੋ ਠੀਕ ਹੈ ਮੈਂ ਹਾਂਜੀ ਹਾਂ ਜਦੋਂ ਬਣਿਆ ਨਾ ਦੇਖਣ ਦਾ ਅਤੇ ਮੈਂ ਤੁਹਾਨੂੰ ਕੋਂਟੈਕਟ ਕਰ ਲਵਾਂਗੀ ਠੀਕ ਹੈ ਜੀ ਸ਼ੁਕਰੀਆ ਸ਼ੁਕਰੀਆ